ਖੇਤੀਬਾੜੀ ਕਰਨ ਦੇ ਲਈ ਆਪਾਂ ਜਿਹੜਾ ਵਾ ਉਹ ਟਿਊਬਵੈਲਾਂ ਦੀ ਵੀ ਵਰਤੋਂ ਕਰਦੇ ਹਾਂ ਨਹਿਰੀ ਪਾਣੀ ਦੀ ਵੀ ਵਰਤੋਂ ਕਰਦੇ ਹਾਂ ਇਹਦੇ ਨਾਲ਼ ਕੀ ਹੁੰਦਾ ਵਾ ਕਿ ਸਭ ਤੋਂ ਜ਼ਿਆਦਾ ਜਿਹੜਾ ਫਾਇਦੇਮੰਦ ਹੁੰਦਾ ਵਾ ਉਹ ਆਪਾਂ ਨੂੰ ਨਹਿਰੀ ਪਾਣੀ ਹੁੰਦਾ ਵਾ ਇਹਦਾ ਇੱਕ ਤਾਂ ਇਹ ਆ ਕਿ ਸਾਨੂੰ ਬਿਜਲੀ ਦਾ ਖਰਚਾ ਬਚ ਜਾਂਦਾ ਸਾਡਾ ਦੂਜਾ ਇਹ ਆ ਕਿ ਆਪਾਂ ਜਿ ਜਿਹਨਾਂ ਦੇ ਖੇਤ ਤਾਂ ਨਹਿਰ ਦੇ ਬਿਲਕੁਲ ਨਾਲ਼ ਲੱਗਦੇ ਆ ਉਹਨਾਂ ਨੂੰ ਇਸ ਸ ਜੇ ਚੀਜ਼ ਦਾ ਜ਼ਿਆਦਾ ਫਾਇਦਾ ਹੁੰਦਾ ਵਾ ਆਪਾਂ ਵੇਖੋ ਕਿ ਜਿਵੇਂ ਜੇ ਤਾਂ ਆਪਾਂ ਖਾਲ੍ਹਾਂ ਬਣਾਉਂਦੇ ਹਾਂ ਫਿਰ ਪਾਣੀ ਜਿਹੜਾ ਵਾ ਉਹ ਜ਼ਿਆਦਾ ਬਰਬਾਦ ਹੁੰਦਾ ਵਾ ਅਤੇ ਜੇਕਰ ਆਪਾਂ ਥੱਲੇ ਜ਼ਮੀਨ ਦੀ ਥੋੜ੍ਹੀ ਜਿਹੀ ਖੁਦਾਈ ਕਰਕੇ ਉਹਦੇ ਵਿੱਚ ਪੂਰੇ ਗੱਡ ਲੈਂਦੇ ਹਾਂ ਤਾਂ ਫਿਰ ਪਾਣੀ ਜਿਹੜਾ ਇੱਕ ਤਾਂ ਉਹਦਾ ਵਹਾਅ ਤੇਜ਼ ਹੁੰਦਾ ਵਾ ਇੱਕ ਸਾਰਾ ਸਾਡੇ ਖੇਤ ਨੂੰ ਹੀ ਜਾਂਦਾ ਵਾ ਜਿਵੇਂ ਕਿ ਅੱਜ ਆਪਾਂ ਅੱਜਕੱਲ੍ਹ ਆਪਾਂ ਜਾਣਦੇ ਹਾਂ ਕਿ ਧਰਤੀ ਹੇਠਲਾ ਪਾਣੀ ਜਿਹੜਾ ਉਹਦਾ ਪੱਧਰ ਜਿਹੜਾ ਵਾ ਉਹ ਘਟਦਾ ਜਾਂਦਾ ਵਾ ਅਤੇ ਇਹਦੇ ਲਈ ਆਪਾਂ ਜਿਹੜੀ ਵੈਸੇ ਤਾਂ ਹਰ ਕਿਸਾਨ ਦੇ ਖੇਤ ਵਿੱਚ ਟਿਊਵੈਲ ਲੱਗਾ ਹੁੰਦਾ ਵਾ ਪਰ ਉਹ ਜਿਹੜਾ ਵਾ ਜ਼ਿਆਦਾ ਫਾਇਦਾ ਜਿਹੜਾ ਵਾ ਉਹ ਨਹਿਰ ਤੋਂ ਲੈ ਲੈਂਦਾ ਵਾ ਫਿਰ ਆਪਾਂ ਆਪਣੇ ਖੇਤਾਂ ਦੇ ਵਿੱਚ ਜਿਹੜੀ ਆ ਕਿ ਸਬਜ਼ੀਆਂ ਵੀ ਲਗਾਉਂਦੇ ਹਾਂ ਅਤੇ ਇਹਨਾਂ ਨੂੰ ਸਿੰਜਾਈ ਇਹਨਾਂ ਦੀ ਸਿੰਜਾਈ ਜਿਹੜੀ ਸਿੰਜਾਈ ਹੈ ਕਰਨ ਦੇ ਲਈ ਜਿਹੜਾ ਵਾ ਇਹ ਕਿਸਾਨ ਜਿਹੜੇ ਆ ਉਹ ਕਿਹੜਾ ਇੱਕ ਫੁਹਾਰਾ ਜਿਹਾ ਲਗਾ ਲੈਂਦੇ ਆ ਉਹਦੇ ਨਾਲ਼ ਓਨਾ ਹੀ ਪਾਣੀ ਵਰਤਿਆ ਜਾਂਦਾ ਵਾ ਜਿੰਨੀ ਆਪਾਂ ਨੂੰ ਲੋੜ ਹੁੰਦੀ ਆ ਬਾਕੀ ਪਾਣੀ ਦਾ ਵੀ ਬਚਾਅ ਹੋ ਜਾਂਦਾ ਵਾ ਇੱਦਾਂ ਕਰਕੇ ਆਪਾਂ ਕਿਹੜੀ ਜਿਹੜੀ ਆਪਾਂ ਆਪਣੀ ਖੇਤ ਆਪਣੀ ਖੇਤੀਬਾੜੀ ਵੀ ਸਾਡੀ ਵਧੀਆ ਢੰਗ ਦੇ ਨਾਲ਼ ਹੋ ਜਾਂਦੀ ਆ ਅਤੇ ਆਪਾਂ ਇੱਕ ਬਰਸਾਤੀ ਪਾਣੀ ਜਿਵੇਂ ਕਿ ਆਪਾਂ ਨੂੰ ਪਤਾ ਵਾ ਜਦੋਂ ਆਪਾਂ ਕਣਕ ਦੀ ਬਿਜਾਈ ਕਰਦੇ ਹਾਂ ਉਦੋਂ ਆਪਾਂ ਨੂੰ ਪਾਣੀ ਦੀ ਘੱਟ ਮਾਤਰਾ 'ਚ ਲੋੜ ਹੁੰਦੀ ਅਤੇ ਪਰ ਜਦੋਂ ਗਰਮੀ ਦੇ ਦਿਨਾਂ ਵਿੱਚ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਆ ਉਦੋਂ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਉਦੋਂ ਆਪਾਂ ਕੀ ਹੁੰਦਾ ਜੇ ਮੀਂਹ ਪੈ ਜਾਣ ਤਾਂ ਇਹ ਸਾਡੇ ਲਈ ਬੜੇ ਫਾਇਦੇਮੰਦ ਹੁੰਦੇ ਕੱਦੂ ਕਰਨ ਵਾਸਤੇ ਸਾਨੂੰ ਜਿਹੜਾ ਵਾ ਇੱਕ ਤਾਂ ਸਾਡਾ ਪਾਣੀ ਜਮ੍ਹਾਂ ਹੋ ਜਾਂਦਾ ਵਾ ਅਤੇ ਇੱਕ ਜਿਹੜੀ ਆ ਆਪਣਾ ਝੋਨਾ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ਼ ਲੱਗ ਜਾਂਦਾ ਵਾ